ਹਾਏ ਨਿਸ਼ਾ

ਵਧੀਆ ਹਮ ਮੈਨੂੰ ਨਾ ਵਧੀਆ ਮੈਨੂੰ ਨਾ ਇੱਕ ਇਨਫੋਰਮੇਸ਼ਨ ਚਾਹੀਦੀ ਸੀ ਆਪਣੇ ਕੋਲਜ ਵਿੱਚ ਕਿਹੜੇ ਕਿਹੜੇ ਤਰ੍ਹਾਂ ਦੀਆਂ ਸਕੋਲਰਸ਼ਿਪ ਹੈਗੀਆਂ ਨੇ ਅੱਛਾ ਉਹਦੇ ਵਿੱਚ ਕੀ ਹੁੰਦਾ

ਓਕੇ ਜਨਰਲ ਤੋਂ ਇਲਾਵਾ ਕਿਹੜੇ ਕਰ ਸਕਦੇ ਐੱਸਸੀ ਕਰ ਸਕਦੇ ਨੇ ਉਹਨਾਂ ਨੂੰ ਕੀ ਸਕੋਲਰਸ਼ਿਪ ਮਿਲਦੀ ਉਹਦੇ ਵਿੱਚ

ਠੀਕ ਆ

ਠੀਕ ਹੈ ਇੱਕ ਮੈਂ ਹੋਰ ਸੁਣੀ ਤੁਹਾਡੇ ਕਾਲਜ ਵਿੱਚ ਬੜੀ ਫੇਮਸ ਸਕੋਲਰਸ਼ਿਪ ਹੈਗੀ ਆ ਕਿ ਜਿਹੜੇ ਬੱਚੇ ਦੇ ਏਟੀ ਪ੍ਰਸੈਂਟ ਤੋਂ ਅਬੱਵ ਮਾਰਕਸ ਹੁੰਦੇ ਆ ਅਤੇ ਉਹਦਾ ਵੀ ਕੁਛ ਕੱਟ ਓਫ ਦਿੰਦੇ ਉਹਨੂੰ ਠੀਕ ਹੈ ਇਹ ਕੌਣ ਫਿਰ ਅਪਲਾਈ ਕੌਣ ਕਰਦਾ ਐੱਚਓਡੀ ਕਰਦਾ ਡਿਪਾਰਟਮੈਂਟ ਦਾ ਚਲੋ ਠੀਕ ਆ ਨੀਸ਼ਾ ਧੰਨਵਾਦ ਮੈਨੂੰ ਦੱਸਣ ਲਈ